ਪਸ਼ੂ ਜਾਨਵਰ ਇਹ ਵੀ ਸਾਡੇ ਜੀਵਨ ਦਾ ਇੱਕ ਅੰਗ ਹੁੰਦੇ ਹਨ ਜਾਨਵਰਾਂ ਨਾਲ ਪਸ਼ੂਆਂ ਨਾਲ ਸਾਡਾ ਰਿਸ਼ਤਾ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਦੂਸਰੇ ਜੀਆਂ ਨਾਲ ਹੁੰਦਾ ਉਸੇ ਤਰ੍ਹਾਂ ਦਾ ਹੀ ਹੁੰਦਾ ਪਸ਼ੂਆਂ ਤੋਂ ਆਦਿ ਸਮੇਂ ਤੋਂ ਅਸੀਂ ਲਗਾਤਾਰ ਖੇਤੀਬਾੜੀ ਲਈ ਦੁੱਧ ਲਈ ਮਾਸ ਲਈ ਆਪਣੀ ਵਰਤੋਂ ਜੋ ਪਦਾਰਥ ਲੈਂਦੇ ਆਏ ਹਾਂ ਅਤੇ ਹੁਣ ਅਸੀਂ ਇਹਨਾਂ ਨਾਲ ਇੰਨੇ ਭਾਵਕ ਤੌਰ 'ਤੇ ਜੁੜ ਚੁੱਕੇ ਹਾਂ ਕਿ ਅਸੀਂ ਜੇਕਰ ਸਾਡੇ ਘਰ ਵਿੱਚ ਕੋਈ ਪਸ਼ੂ ਭੁਰ ਜਾਂਦਾ ਹੈ ਜਾਣੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਉਹਦਾ ਇੱਕ ਸਦਮਾ ਲੱਗਦਾ ਹੈ ਆਰਥਿਕ ਘਾਟਾ ਤਾਂ ਹੁੰਦਾ ਹੀ ਹੁੰਦਾ ਹੈ ਇਸੇ ਤਰ੍ਹਾਂ ਪੰਛੀ ਜੋ ਸਾਡੇ ਘਰ ਵਿੱਚ ਆਲ੍ਹਣੇ ਬਣਾ ਲੈਂਦੇ ਹਨ ਅਸੀਂ ਉਹਨਾਂ ਨੂੰ ਦਾਣੇ ਪਾਉਂਦੇ ਰਹਿੰਦੇ ਹਾਂ ਉਹ ਸਾਡਾ ਭਾਵਕ ਰਿਸ਼ਤਾ ਹੁੰਦਾ ਹੈ ਉਹ ਪੰਛੀ ਸਾਡੇ ਤੋਂ ਡਰਦੇ ਨਹੀਂ ਸਗੋਂ ਸਾਡੇ ਕੋਲ ਆ ਕੇ ਸਾਡਾ ਮਨ ਬਹਿਲਾਉਂਦੇ ਹਨ ਸਾਨੂੰ ਪਸ਼ੂਆਂ ਅਤੇ ਪੰਛੀਆਂ ਨਾਲ ਬਹੁਤ ਨੇੜਤਾ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ